ਸਾਡਾ ਸਭ ਤੋਂ ਯਾਦਗਾਰ ਬਾਈਕਿੰਗ ਅਨੁਭਵ ਕੀ ਸੀ ਅਤੇ ਇਹ ਇੰਨਾ ਖ਼ਾਸ ਕਿਉਂ ਸੀ ਅਸੀਂ ਇੱਕ ਵਾਰ ਮਾਤਾ ਚਿੰਤਪੁਰਨੀ ਗਏ ਹੌਲੀ ਹੌਲੀ ਅਸੀਂ ਬਰਸਾਤ ਦੇ ਮੌਸਮ ਵਿੱਚ ਹੌਲੀ ਹੌਲੀ ਪਹਾੜਾਂ ਦੇ ਖੇਤਰਾਂ ਵੱਲ ਨੂੰ ਵਧਣਾ ਸ਼ੁਰੂ ਕੀਤਾ ਰਸਤੇ ਦੇ ਵਿੱਚ ਬਹੁਤ ਕਠਿਨਾਈ ਆਇਆ ਔਰ ਮੀਂਹ ਔਰ ਗਰਜ ਬਹੁਤ ਤੇਜ਼ ਸੀ ਹਵਾ ਬਹੁਤ ਤੇਜ਼ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ ਕਿ ਮੋਟਰਸਾਈਕਲ ਚਲਾਉਂਦੇ ਚਲਾਉਂਦੇ ਕੰਨਾਂ ਦੇ ਵਿੱਚ ਸਾਂ ਸਾਂ ਹੋ ਰਹੀ ਸੀ ਬਹੁਤ ਮੁਸ਼ਕਿਲ ਦੇ ਨਾਲ ਅਸੀਂ ਮਾਤਾ ਜੀ ਦੇ ਦਰਬਾਰ ਤੱਕ ਪਹੁੰਚਣ ਵਾਸਤੇ ਬਹੁਤ ਕਠਿਨ ਤਪੱਸਿਆ ਕੀ ਕੀਤੀ ਅਤੇ ਬੜੀ ਮੁਸ਼ਕਿਲ ਦੇ ਨਾਲ ਪਹੁੰਚੇ ਔਰ ਮਾਤਾ ਜੀ ਨੂੰ ਨਮਸਕਾਰ ਕੀਤਾ ਹੌਲੀ ਹੌਲੀ ਅਸੀਂ ਜਵਾਲਾ ਜੀ ਵੱਲ ਨੂੰ ਵਧੇ